ਹਾਂਜੀ ਬੱਚਿਆਂ ਨੂੰ ਸਕੂਲ ਵਿੱਚ ਸਿਲੇਬਸ ਕਿੱਦਾਂ ਦੇ ਹੋਣੇ ਚਾਹੀਦੇ ਹੈ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵਾ ਵੀ ਅਸੀਂ ਨੀਤੀਆਂ ਦਾ ਇਹਨਾਂ ਨੂੰ ਕਰਜਿਆਂ ਬਾਰੇ ਟੈਕਸਾਂ ਬਾਰੇ ਆ ਜਾਣਕਾਰੀ ਦੇਣੀ ਚਾਹੀਦੀ ਹੈ ਬੱਚਿਆਂ ਨੂੰ ਇਹਨਾਂ ਨੂੰ ਉਹਨਾਂ ਨੂੰ ਪਤਾ ਲੱਗੇ ਵੀ ਆਉਣ ਟਾਈਮ ਵਿੱਚ ਬੱਚੇ ਬਹੁਤ ਹੋਣੇ ਚਾਹੀਦੇ ਹਨ ਉਹਨਾਂ ਨੂੰ ਸਲੇਬਸ ਬਾਰੇ ਇਹਨਾਂ ਦੀਆਂ ਨੀਤੀਆਂ ਜਿਵੇਂ ਕਿ ਟੈਕਸਾਂ ਬਾਰੇ ਹੋਰ ਕਰਜਿਆਂ ਦੇ ਅੱਜ ਕੱਲ੍ਹ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਬੈਂਕ ਵਿੱਚ ਕਿਵੇਂ ਪੈਸੇ ਜਮ੍ਹਾਂ ਕਰਾਉਣੇ ਕਿਵੇਂ ਕਰਨੇ ਜੋ ਕਿਵੇਂ ਕੱਢਣੇ ਆ ਕਢਾਉਣੇ ਹੈ ਨਾ ਤਾਂ ਪਤਾ ਨਹੀਂ ਇਕਨੋਮਿਕਸ ਬਾਰੇ ਵੀ ਬੱਚਿਆਂ ਨੂੰ ਇਹਨਾਂ ਡੀਟੇਲ ਦੇਣੀ ਚਾਹੀਦੀ ਹੈ ਬੱਚਿਆਂ ਨੂੰ ਬਾਕੀ ਅੱਜ ਕੱਲ੍ਹ ਤਾਂ ਬੱਚਿਆਂ ਨੂੰ ਕਾਲਜ ਵਾਲਿਆਂ ਨੂੰ ਵੀ ਨਹੀਂ ਪਤਾ ਲੱਗਦਾ ਵੀ ਕਿੰਨਾ ਕਾ ਕਿਵੇਂ ਕਰਨ ਜਾਂਦੇ ਹਾਜ ਰਿਟਰਨ ਕਿਵੇਂ ਕਰਨੀ ਚੀਜ਼ ਲੈਣੀ ਕਿਵੇਂ ਆ ਇਹਨਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਇਸ ਟੈਕਸ ਦੀ ਜੋ ਜੋ ਕਰਜਿਆਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਜਿਵੇਂ ਅਸੀਂ ਕਿਸੇ ਨੂੰ ਦਿੰਦੇ ਹਾਂ ਲੈਂਦੇ ਹਾਂ ਇਹਨਾਂ ਚੀਜ਼ਾਂ ਬਾਰੇ ਪਤਾ ਹੋਣਾ ਹਾਂਜੀ ਇਹਨਾਂ ਬੱਚਿਆਂ ਬਾਰੇ ਸਾਰੇ ਸਕੂਲਾਂ ਵਿੱਚ ਬੱਚਿਆਂ ਨੂੰ ਦੱਸਣੀ ਚਾਹੀਦੀ ਆ ਡਿਟੇਲ ਵੀ ਬੱਚਾ ਆਉਣ ਵਾਲਾ ਆਪਣੀ ਲਾਈਫ ਅਤੇ ਜ਼ਿੰਦਗੀ ਦੇ ਵਿੱਚ ਪਤਾ ਲੱਗ ਸਕੇ ਉਹਨਾਂ ਨੂੰ